ਮੇਰੇ ਕੋਲ ਧਾਰਮਿਕ ਅਭਿਆਸਾਂ ਨਾਲ ਸਬੰਧਿਤ ਬਹੁਤ ਸਾਰੇ ਗੀਤ ਹਨ ਔਰ ਮੈਂ ਧਾਰਮਿਕ ਗੀਤਾਂ ਨੂੰ ਸੁਣਨਾ ਬਹੁਤ ਪਸੰਦ ਕਰਦੀ ਹਾਂ ਇੱਕ ਲੈਅ ਦੇ ਵਿੱਚ ਗਾਏ ਹੋਏ ਧਾਰਮਿਕ ਗੀਤ ਜਿਹੜੇ ਨੇ ਇਹ ਕਿਤੇ ਨਾ ਕਿਤੇ ਸਾਡੇ ਮਨ ਨੂੰ ਸ਼ੁੱਧ ਕਰਦੇ ਨੇ ਸਾਡੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਕਲੀਅਰ ਕਰਦੇ ਨੇ ਹੁਣ ਦੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਧਾਰਮਿਕ ਜਿਹੜੇ ਗੀਤ ਨੇ ਉਹਨਾਂ ਨੂੰ ਸੁਣੀਏ ਅਤੇ ਉਹਨਾਂ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ ਗੁਰਪੁਰਬ ਵਗੈਰਾ ਜਦੋਂ ਮਨਾਏ ਜਾਂਦੇ ਨੇ ਜਾਂ ਕੋਈ ਧਾਰਮਿਕ ਸਮਾਗਮ ਪੰਜਾਬੀ ਸੱਭਿਆਚਾਰ ਦੇ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਹੁੰਦਾ ਹੈ ਤਾਂ ਇਹਨਾਂ ਗੀਤਾਂ ਨੂੰ ਉੱਥੇ ਚਲਾਇਆ ਜਾਂਦਾ ਹੈ ਔਰ ਇਹ ਜਿਹੜੇ ਗੀਤ ਨੇ ਲੋਕ ਸੁਣਦੇ ਨੇ ਔਰ ਸੁਣ ਕੇ ਇਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਇਹਨਾਂ ਰਾਹੀਂ ਸਿੱਖਿਆਵਾਂ ਨੇ ਉਹ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਧਾਰਦੇ ਨੇ ਕਹਿੰਦੇ ਨੇ ਕਿ ਅਗਰ ਅਸੀਂ ਆਪਣਾ ਆਲਾ ਦੁਆਲਾ ਅਤੇ ਜਿਹੜਾ ਵਾਤਾਵਰਨ ਹੈ ਉਹਨੂੰ ਪੋਜੀਟਿਵ ਰੱਖੀਏ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਦਿਮਾਗ ਹੈ ਉਹ ਵੀ ਸਕਾਰਾਤਮਕ ਜਿਹੜੇ ਵਿਚਾਰ ਨੇ ਉਹਨਾਂ ਦੇ ਨਾਲ ਭਰ ਜਾਂਦਾ ਹੈ ਮੈਂ ਇਸ ਗੱਲ 'ਤੇ ਪਰਸਨਲੀ ਜਿਹੜਾ ਅਮਲ ਕਰਦੀ ਹਾਂ ਔਰ ਮੇਰੇ ਬਹੁਤ ਸਾਰੇ ਅਧਿਆਤਮਿਕ ਗੀਤ ਨੇ ਜਿਹੜੇ ਮੈਨੂੰ ਪਸੰਦ ਨੇ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਹੈ ਆਰ ਨਾਨਕ ਪਾਰ ਨਾਨਕ ਸਭ ਦਾ ਬੇੜਾ ਤਾਰ ਨਾਨਕ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਹੁਣ ਕਿਸ ਕਰਕੇ ਪਸੰਦ ਹੈ ਇਹਦਾ ਕੋਈ ਰੀਜ਼ਨ ਜਿਹੜਾ ਪਰਟੀਕੁਲਰ ਉਹ ਇਹ ਨਹੀਂ ਹੁੰਦਾ ਪਸੰਦ ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਜਿੰਨਾ ਚੀਜ਼ਾਂ ਦੇ ਨਾਲ ਸ ਸਾਡੇ ਮਨ ਦੇ ਵਿਚਾਰ ਸ਼ੁੱਧ ਹੁੰਦੇ ਨੇ ਸਾਡੇ ਮਨ ਨੂੰ ਸ਼ੁੱਧੀ ਪ੍ਰਦਾਨ ਕਰਦੇ ਨੇ ਸਾਨੂੰ ਨਵੀਂ ਸੇਧ ਦਿੰਦੇ ਨੇ ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਉਹ ਮੈਨੂੰ ਪਸੰਦ ਨੇ